ਦੋ ਫਰਵਰੀ ਵੀਹ ਦਸ ਪੰਦਰਾਂ ਮਾਰਚ ਵੀਹ ਬਾਰਾਂ ਨੌਂ ਜਨਵਰੀ ਵੀਹ ਸਤਾਰਾਂ ਅਠਾਰਾਂ ਅਪ੍ਰੈਲ ਵੀਹ ਵੀਹ ਸਤਾਈ ਨਵੰਬਰ ਵੀਹ ਬਾਈ